ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਲ ਇੱਕ ਬੈਡਸ਼ੀਟ ਦਾ ਔਡਰ ਕੀਤਾ ਸੀ ਪੰਦਰ੍ਹਾਂ ਦਿਨ ਪਹਿਲਾਂ ਅਤੇ ਪਹਿਲਾਂ ਤਾਂ ਉਹ ਟਾਈਮ ਨਾਲ਼ ਨਹੀਂ ਆਇਆ ਮੇਰੇ ਕੋਲ ਅਤੇ ਉਸ ਤੋਂ ਬਾਅਦ ਉਸਦੀ ਪੈਕਜਿੰਗ ਵੀ ਬਹੁਤ ਖਰਾਬ ਸੀ ਅਤੇ ਜੋ ਕਲਰ ਮੰਗਵਾਇਆ ਸੀ ਉਹ ਤਾਂ ਬਿਲਕੁਲ ਹੀ ਨਹੀਂ ਸੀ ਚਾਦਰ ਵੀ ਸੇਮ ਹੀ ਨਹੀਂ ਸੀ ਵੈਸੇ ਤਾਂ ਕੁਆਲਿਟੀ ਬਹੁਤ ਬੇਕਾਰ ਸੀ ਪ੍ਰਿੰਟ ਵੀ ਨਹੀਂ ਵਧੀਆ ਸੀ ਉਹਦਾ ਅਤੇ ਉਸ ਤੋਂ ਬਾਅਦ ਮਾਰਕੀਟ ਨਾਲੋਂ ਵੀ ਮੈਨੂੰ ਬਹੁਤ ਜ਼ਿਆਦਾ ਮਹਿੰਗੀ ਪਈ ਆ ਅਤੇ ਉਹਦੇ ਇੱਕ ਵਾਰੀ ਧੋਣ ਤੋਂ ਬਾਅਦ ਹੀ ਉਹਦਾ ਜਿਹੜਾ ਰੰਗ ਹੈ ਉਹਦਾ ਫੇਟ ਹੋ ਗਿਆ ਅਤੇ ਕੋਟਨ ਦਾ ਜਿਹੜਾ ਸਟੱਫ ਸੀਗਾ ਉਹ ਵੀ ਬਿਲਕੁਲ ਨਹੀਂ ਸੀ ਕੋਟਨ ਦੀ ਤਾਂ ਬਿਲਕੁਲ ਹੀ ਨਹੀਂ ਲੱਗ ਰਹੀ ਸੀ ਉਹ ਚਾਦਰ ਅਤੇ ਇੱਕ ਅਤੇ ਆਲ਼ੇ ਦੁਆਲ਼ੇ ਦਿਖਾਉਣ ਤੋਂ ਬਾਅਦ ਵੀ ਅਤੇ ਘਰਦਿਆਂ ਨੂੰ ਬਿਲਕੁਲ ਉਹ ਚਾਦਰ ਪਸੰਦ ਨਹੀਂ ਆਈ ਅਤੇ ਜਿਹਨਾਂ ਨੇ ਔਡਰ ਕੀਤਾ ਹੋਇਆ ਸੀ ਉਹਨਾਂ ਦਾ ਵੀ ਮੈਂ ਔਡਰ ਕੈਂਸਲ ਕਰ ਦਿੱਤਾ ਕਿਉਂਕਿ ਤੁਸੀਂ ਸੇਮ ਚਾਦਰ ਬਿਲਕੁਲ ਨਹੀਂ ਭੇਜਦੇ ਅਤੇ ਉਸ ਤੋਂ ਬਾਅਦ ਤੁਹਾਡਾ ਡਿਲੀਵਰੀ ਬੋਆਏ ਸੀ ਉਹ ਵੀ ਬਿਲਕੁਲ ਬੇਕਾਰ ਸੀ ਅਤੇ ਉਹ ਵੀ ਮੇਰੇ ਮੇਰੇ ਤੋਂ ਐਕਸਟਰਾ ਚਾਰਜਿਸ ਲੈ ਕੇ ਗਿਆ ਬੜੇ ਡਿਲੀਵਰੀ ਕਰਨ ਦੇ ਜਾਂ ਤਾਂ ਤੁਸੀਂ ਮੇਰਾ ਔਨਲਾਈਨ ਜੋ ਦਿਖਾਇਆ ਔਨਲਾਈਨ ਐ ਉਹ ਭੇਜੋ ਜਾਂ ਫਿਰ ਤੁਸੀਂ ਮੇਰੇ ਪੈਸੇ ਵਾਪਸ ਕਰੋ ਕਿਉਂਕਿ ਤੁਸੀਂ ਮੈਨੂੰ ਕੁਆਲਿਟੀ ਸੇਮ ਨਹੀਂ ਭੇਜੀ ਸੀ ਧੰਨਵਾਦ ਜੀ